ਹੈਲੋ ਹਾਂਜੀ ਹਾਂਜੀ ਪ੍ਰਿਤਪਾਲ ਸਿੰਘ ਬੋਲਦਾ ਜੀ ਸਤਿ ਸ਼੍ਰੀ ਅਕਾਲ ਜੀ ਅੱਛਿਆ ਜੀ ਹਾਂਜੀ ਹਾਂ ਜ਼ਰੂਰ ਦੱਸਾਂਗੇ ਇੱਥੇ ਸਭ ਤੋਂ ਬੜੀ ਕੁਰਬਾਨੀ ਤਾਂ ਮਹਾਰਾਜਾ ਦਸਵਾਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਦੀ ਆ ਜੀ ਇੱਥੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੂੰ ਜਿੰਨਾਂ ਦੀ ਉਮਰ ਨੌ ਅਤੇ ਸੱਤ ਸਾਲ ਦੀ ਸੀ ਉਹਨਾਂ ਨੂੰ ਇੱਥੇ ਵਜ਼ੀਰ ਖਾਨ ਨੇ ਈਨ ਨਾ ਮੰਨਣ ਕਰਕੇ ਨੀਹਾਂ ਦੇ ਵਿੱਚ ਚਿਣਿਆ ਤੀ ਜੀ ਪਰ ਉਹੀ ਨੀਹਾਂ ਅੱਜ ਵੀ ਇੱਥੇ ਮੌਜੂਦ ਨੇ ਜੀ ਉਹ ਜਿੰਨਾਂ ਨੀਹਾਂ ਦੇ ਵਿੱਚ ਚਿਣੇ ਤੀ ਨਾ ਸਾਹਿਬਜ਼ਾਦਿਆਂ ਨੂੰ ਉਹ ਨੀਹਾਂ ਅੱਜ ਵੀ ਇੱਥੇ ਉਸੇ ਤਰ੍ਹਾਂ ਮੌਜੂਦ ਨੇ ਅਤੇ ਜਿਹੜੇ ਠੰਡੇ ਬੁਰਜ ਦੇ ਵਿੱਚ ਕੈਦ ਰੱਖਿਆ ਸੀਗਾ ਮਾਤਾ ਗੁਜਰ ਕੌਰ ਅਤੇ ਦੋ ਬੱਚਿਆਂ ਨੂੰ ਫਿਰ ਬਾਬਾ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਨੂੰ ਜੀ ਉਹ ਵੀ ਇੱਥੇ ਉਸੇ ਤਰ੍ਹਾਂ ਠੰਡੇ ਬੁਰਜ ਗੁਰਦੁਆਰਾ ਸਾਹਿਬ ਬਣਿਆ ਹੋਇਆ ਉਹ ਵੀ ਉਸੇ ਤਰ੍ਹਾਂ ਮੌਜੂਦ ਆ ਉਸ ਤੋਂ ਬਿਨਾਂ ਜਿੱਥੇ ਇਹਨਾਂ ਦਾ ਸੰਸਕਾਰ ਕਰਿਆ ਸੀ ਮੋਹਰਾਂ ਵਿਛਾ ਕੇ ਜੀ ਸਭ ਤੋਂ ਮਹਿੰਗੀ ਜ਼ਮੀਨ ਖਰੀਦ ਕੇ ਦੀਵਾਨ ਟੋਡਰ ਮੱਲ ਨੇ ਉੱਥੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਬਣਿਆ ਹੋਇਆ ਜੀ ਉੱਥੇ ਅੱਜ ਵੀ ਉਹ ਜਗ੍ਹਾ ਮੌਜੂਦ ਆ ਜਿੱਥੇ ਉਹ ਤਿੰਨ ਦੇਹਾਂ ਦਾ ਸੰਸਕਾਰ ਕਰਿਆ ਸੀਗਾ ਜੀ ਉਹ ਤੋਂ ਬਾਅਦ ਜੀ ਇੱਥੇ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਦੁੱਧ ਪਿਲਾਇਆ ਸੀ ਬੱਚਿਆਂ ਨੂੰ ਉਹਨਾਂ ਦੀ ਯਾਦਗਾਰ 'ਚ ਗੁਰਦੁਆਰਾ ਬਣਿਆ ਹੋਇਆ ਜੀ ਉਹਨਾਂ ਨੇ ਜਿਹੜੇ ਗਲਾਸਾਂ 'ਚ ਦੁੱਧ ਪਿਲਾਇਆ ਤਾ ਉਹ ਵੀ ਹੈਗੇ ਨੇ ਜੀ ਇਸ ਤੋਂ ਬਾਅਦ ਦੀਵਾਨ ਟੋਡਰ ਮੱਲ ਦੀ ਹਵੇਲੀ ਵੀ ਹੈਗੀ ਆ ਜਿਹਨੇ ਜਗ੍ਹਾ ਖਰੀਦੀ ਤੀ ਜੀ ਇੱਥੇ ਅਤੇ ਇੱਕ ਮੁਸਲਿਮ ਧਰਮ ਦਾ ਬਹੁਤ ਤਕੜਾ ਸਥਾਨ ਆ ਜਿਹਨੂੰ ਇੱਥੇ ਇ ਉਹ ਵੀ ਇੱਥੇ ਨਾਲ ਬਣਿਆ ਹੋਇਆ ਹੈਗਾ ਜੀ ਸੋ ਤੁਸੀਂ ਆ ਜਿਓ ਜਦ ਮਰਜੀ ਮੈਨੂੰ ਫੋਨ ਕਰਕੇ ਆ ਜਿਓ ਆਪਾਂ ਤੁਹਾਨੂੰ ਸਾਰੇ ਥਾਂ ਘੁੰਮਾ ਕੇ ਲਿਆਵਾਂਗੇ ਜੀ ਵਾ ਠੀਕ ਆ ਜੀ ਆ ਜਿਓ ਕੋਈ ਗੱਲ ਨਹੀਂ ਜ਼ਰੂਰ ਚੰਗਾ ਜੀ